ਪੰਜਾਬ ਦਾ ਵਿਰਸਾ ਬਹੁਤ ਹੀ ਅਮੀਰ ਵਿਰਸਾ ਹੈ ਪੰਜਾਬੀ ਸਾਹਿਤ ਹੀ ਉਸਦਾ ਇੱਕ ਭਾਗ ਹੈ ਪੰਜਾਬੀ ਸਾਹਿਤ ਵਿੱਚ ਬਹੁਤ ਵੀ ਮਹਾਨ ਕਵੀ ਅਤੇ ਮਹਾਨ ਲੇਖਕ ਹੋਏ ਹਨ ਚਾਹੇ ਉਹ ਬਾਬਾ ਬੁੱਲੇ ਸ਼ਾਹ ਹੋਣ ਚਾਹੇ ਵਾਰਿਸ਼ ਸ਼ਾਹ ਦੇ ਵਾਰਿਸ਼ ਸ਼ਾਹ ਹੋਣ ਚਾਹੇ ਉਹ ਪ੍ਰ ਪ੍ਰੋਫੈਸਰ ਪੂਰਨ ਸਿੰਘ ਹੋਣ ਚਾਹੇ ਪ੍ਰੋਫੈਸਰ ਵੀਰ ਸਿੰਘ ਹੋਣ ਜਾਂ ਫਿਰ ਜਾਂ ਫਿਰ ਸੁਰਜੀਤ ਪਾਤਰ ਜੀ ਹੋਣ ਬਹੁਤ ਹੀ ਮਹਾਨ ਕਵੀ ਅਤੇ ਲੇਖਕ ਹੋਏ ਹਨ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਮਹਾਨ ਵਧੀਆ ਵਧੀਆ ਰਚਨਾਵਾਂ ਦਿੱਤੀਆਂ ਹਨ ਜਿਸ ਨੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਹੁਣ ਮੈਂ ਮੈਂ ਵੱਖ ਵੱਖ ਕਵੀਆਂ ਅਤੇ ਲੇਖਕਾਂ ਇਹਨਾਂ ਦੀਆਂ ਰਚਨਾਵਾਂ ਨੂੰ ਪੜ੍ਹ ਕੇ ਆਪਣੇ ਆਪ ਮੇਰੇ 'ਤੇ ਪ੍ਰਭਾਵਿਤ ਪ੍ਰਭਾਵ ਪਿਆ ਕਿ ਮੈਂ ਵੀ ਕੁਛ ਨਾ ਕੁਛ ਲੇਖਣ ਕਰ ਸਕਦੀ ਹਾਂ ਜਾਂ ਫਿਰ ਕੋਈ ਕਵਿਤਾ ਜਾਂ ਕਹਾਣੀ ਕਰ ਸਕਦੀ ਹਾਂ ਇਸ ਦੇ ਨਾਲ ਹੀ ਫਿਰ ਮੈਂ ਸ਼ੁਰੂ ਕੀਤਾ ਕਿ ਮੈਂ ਕਿਹੜੇ ਕਿਹੜਾ ਟੋਪਿਕ ਲੈ ਕੇ ਕਿਸ ਨੂੰ ਪੜ੍ਹ ਸਕਦੀ ਹਾਂ ਕਿਸ ਬਾਰੇ ਲਿਖ ਸਕਦੀ ਹਾਂ ਚਾਹੇ ਮੈਂ ਵੱਡੇ ਲੋਕਾਂ ਬਜ਼ੁਰਗਾਂ ਨੂੰ ਮੇਰੇ ਘਰ ਵਿੱਚ ਜਿਵੇਂ ਦਾਦੀ ਜੀ ਹਨ ਮੇਰੇ ਨਾਨੀ ਜੀ ਹਨ ਮੇਰੇ ਦਾਦਾ ਜੀ ਮੇਰੇ ਨਾਨਾ ਜੀ ਜਾ ਫਿਰ ਗੁਆਂਢ ਵਿੱਚ ਕੋਈ ਵੀ ਹੈ ਉਹਨਾਂ ਦੇ ਨਾਲ ਗੱਲਬਾਤ ਕਰਕੇ ਕਿ ਪਹਿਲਾਂ ਦੇ ਸਾਹਿਤ ਵਿੱਚ ਕੀ ਸੀ ਪਹਿਲਾਂ ਦੀਆਂ ਕਹਾਣੀਆਂ ਕੀ ਸਨ ਵੀ ਪਹਿਲਾਂ ਕਿਵੇਂ ਦੇ ਲੇਖਣ ਹੁੰਦੇ ਸਨ ਪਹਿਲਾਂ ਬਾਰੇ ਕੀ ਸੋਚ ਸੀ ਉਸ ਦੇ ਆਧਾਰ 'ਤੇ ਹੀ ਸਭ ਲੇਖਣ ਹੁੰਦਾ ਸੀ ਅਤੇ ਅੱਜ ਕੱਲ੍ਹ ਜਿਵੇਂ ਮੋਡਰਨਾਈਜ ਹੋ ਗਿਆ ਹੈ ਮੋਡਰਨਾਈਸ ਮੋਡਰਨ ਦੇ ਨਾਲ ਨਾਲ ਕੀ ਆ ਉਸ ਤਰ੍ਹਾਂ ਹੀ ਲੇਖਣ ਸਾਹਿਤ ਵੀ ਬਦਲਦਾ ਜਾ ਰਿਹਾ ਹੈ ਤਾਂ ਮੈਂ ਵੀ ਇਸ ਚੀਜ਼ 'ਤੇ ਲਿਖਣਾ ਸ਼ੁਰੂ ਕੀਤਾ ਕਿ ਵੀ ਪਹਿਲਾਂ ਸਾਡੇ ਪਹਿਲਾਂ ਸਾਡੇ ਪੰਜਾਬੀ ਸਾਹਿਤ ਵਿੱਚ ਕੀ ਕੀ ਕੀ ਹੁੰਦਾ ਸੀ ਕਿਹੜੇ ਟੋਪਿਕ ਲੈ ਕੇ ਕੇ ਇਹਨਾਂ ਬਾਰੇ ਲਿਖਿਆ ਜਾਂਦਾ ਸੀ ਅਤੇ ਅੱਜ ਕੱਲ੍ਹ ਉਸ ਵਿੱਚ ਕੀ ਚੇਂਜ ਆਇਆ ਹੈ ਫਿਰ ਮੈਂ ਇਸ ਟੋਪਿਕ ਨੂੰ ਲੈ ਕੇ ਇਸ ਬਾਰੇ ਲਿਖਣ ਬਾਰੇ ਸੋਚਿਆ ਅਤੇ ਇਸ ਬਾਰੇ ਲਿਖਣਾ ਸ਼ੁਰੂ ਕੀਤਾ ਕਿ ਇਸ ਵਿੱਚ ਕੀ ਕੀ ਅੰਤਰ ਹਨ ਇਹਨਾਂ ਵਿੱਚ ਕੀ ਚੰਗਾ ਹੈ ਕੀ ਮਾੜਾ ਹੈ ਜਾਂ ਕਿਸ ਤਰ੍ਹਾਂ ਪ੍ਰਭਾਵ ਪ੍ਰਭਾਵਿਤ ਮੈਂ ਇਹਨਾਂ ਤੋਂ ਹੋਈ ਹਾਂ